ਸਾਡੇ ਖੇਤਰ ਵਿੱਚ ਇੱਕ ਟੂਰ ਗਾਈਡ ਸੰਸਥਾ ਹੈ ਠੀਕ ਹੈ ਇਹ ਸੰਸਥਾ ਬਾਹਰ ਤੋਂ ਆਏ ਲੋਕਾਂ ਨੂੰ ਠੀਕ ਹੈ ਸਾਡੇ ਸ ਸਾਡੇ ਖੇਤਰ ਵਿੱਚ ਜਿਹੜੇ ਪ੍ਰਸਿੱਧ ਜਗ੍ਹਾ ਜਾਂ ਪ੍ਰਸਿੱਧ ਟੂਰ ਵਾਲੀ ਜਗ੍ਹਾ ਠੀਕ ਹੈ ਉਹਨਾਂ 'ਤੇ ਘੁਮਾਉਂਦੀ ਹੈ ਠੀਕ ਹੈ ਜਿਹੜੀ ਇਹ ਸੰਸਥਾ ਹੈ ਇਸ ਵਿੱਚ ਕਈ ਤਰ੍ਹਾਂ ਦੀ ਭਾਸ਼ਾਵਾਂ ਜਿਵੇਂ ਕਿ ਕਹਿ ਲਓ ਹਿੰਦੀ ਅੰਗਰੇਜ਼ੀ ਮਰਾਠੀ ਗੁਜਰਾ ਗੁਜਰਾਤੀ ਆਦਿ ਵਰਗੀ ਹੋਰ ਭਾਸ਼ਾਵਾਂ ਦੁਆਰਾ ਉਹਨਾਂ ਨੂੰ ਉਸ ਸੰਸਥਾ ਬਾਰੇ ਸਮਝਾਇਆ ਜਾਂਦਾ ਹੈ ਠੀਕ ਹੈ ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੀ ਇਹੋ ਜਿਹੀ ਸੰਸਥਾਵਾਂ ਹਨ ਜਿਵੇਂ ਕਿ ਲਾ ਲਉ ਵੀ ਭੱਠਾ ਸਾਹਿਬ ਟਿੱਬੀ ਸਾਹਿਬ ਇਹ ਹੈੱਡ ਵਰਕਸ ਅਨੰਦਪੁਰ ਸਾਹਿਬ ਅਤੇ ਹੋਰ ਵੀ ਬਹੁਤ ਸਾਰੀਆਂ ਚੀ ਬਹੁਤ ਸਾਰੀ ਸੰਸਥਾਵਾਂ ਹਨ ਜੋ ਕਿ ਟੂਰਿਸਟ ਟੂਰਿਸਟ ਗਾਈਡ ਟੂਰਿਸਟ ਤੌਰ 'ਤੇ ਜਾ ਸਕਦੇ ਹਨ ਠੀਕ ਹੈ ਅਤੇ ਇਹ ਟੂਰ ਗਾਈਡ ਕੰਪਨੀ ਆਪਣੇ ਵਧੀਆ ਹੀ ਪ੍ਰਬੰ ਪ੍ਰਬੰਧ ਕਰਕੇ ਇਨ੍ਹਾਂ ਟੂਰਿਸਟਾਂ ਨੂੰ ਠੀਕ ਹੈ ਇਹਨਾਂ ਨੂੰ ਇਸ ਇਸ ਖੇਤਰ ਦੇ ਸੰਸਥਾਵਾਂ ਜਿਹੜੀ ਟੂਰਿਸਟ ਸੰਸਥਾਂਵਾਂ ਉਨ੍ਹਾਂ ਬਾਰੇ ਗਾਈਡ ਕਰਦੀ ਹੈ